ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਮੈਮ ਮਿਲ ਜਾਣਗੇ ਜੀ ਹਾਂਜੀ ਬਿਲਕੁਲ ਵਧੀਆ ਕੁਆਲਟੀ ਦੀਦੀ ਹੱਥੀਂ ਤਿਆਰ ਕੀਤੇ ਜਾਂਦੇ ਆਪਣੇ ਇੱਕ ਵਾਰ ਵਿਜਿਟ ਕਰਕੇ ਦੇਖਿਓ ਤੁਸੀਂ ਹਾਂਜੀ ਹਾਂਜੀ ਬਿਲਕੁਲ ਅਲਮਾਰੀਆਂ ਕੁਰਸੀ ਟੇਬਲ ਵੀ ਮਿਲ ਜਾਂਦੇ ਨੇ ਇੱਕ ਵਾਰੀ ਤੁਸੀਂ ਆਇਓ ਅਤੇ ਚੈੱਕ ਕਰਕੇ ਜਾਇਓ ਖੁਦ ਹੱਥੀਂ ਤਿਆਰ ਕੀਤੇ ਜਾਂਦੇ ਜੀ ਆਪਣੇ ਅੱਛਾ ਜੀ ਹਾਂਜੀ ਬਿਲਕੁਲ ਉਹ ਆਪਣੀ ਵਧੀਆ ਗਾਰੰਟੀ ਦੀ ਚੀਜ਼ ਹੁੰਦੀ ਹੈਗੀ ਨਾਲੇ ਵਧੀਆ ਚੀਜ਼ ਬਣਾਈ ਜਾਂਦੀ ਹੈ ਵਧੀਆ ਲੱਕੜੀ ਇਸਤੇਮਾਲ ਕੀਤੀ ਜਾਂਦੀ ਹੈ ਅਤੇ ਬਿਲਕੁਲ ਵਧੀਆ ਫਰਨੀਚਰ ਬਣਾਇਆ ਜਾਂਦਾ ਜੀ ਆਪਣੇ ਇੱਕ ਵਾਰ ਤੁਸੀਂ ਵਿਜਿਟ ਕਰੋ ਅਤੇ ਦੇਖੋ ਹਾਂਜੀ ਆਪਣੇ ਜੀ ਬਰਨਾਲੇ ਰਹਿ ਜਾਂਦੀ ਹੈ ਜੀ ਕੇ ਸੀ ਰੋਡ ਕੋਲ ਹਾਂਜੀ ਸਿੱਧੇ ਰੋਡ 'ਤੇ ਇੱਕ ਵਾਰ ਆਇਓ ਤੁਸੀਂ ਹਾਂਜੀ ਹਾਂਜੀ ਬਿਲਕੁਲ ਹਾਂਜੀ ਬਿਲਕੁਲ ਜੀ ਇੱਕ ਵਾਰ ਆਇਓ ਜ਼ਰੂਰ ਵਿਜਿਟ ਕਰੋ ਤੁਸੀਂ ਵੈਲਕਮ ਜੀ ਹਾਂਜੀ ਬਿਲਕੁਲ ਜੀ ਜ਼ਰੂਰ ਜੀ ਕੌਲ ਕਰਿਓ ਤੁਸੀਂ ਇੱਕ ਵਾਰ

ਹਾਂਜੀ ਹਾਂਜੀ ਬਿਲਕੁਲ ਜੀ ਮਿਲ ਜਾਣਗੇ ਜੀ ਟੇਬਲ ਕੁਰਸੀ ਜੋ ਵੀ ਚੀਜ਼ ਚਾਹੀਦੀ ਹੋਈ ਤੁਹਾਨੂੰ ਸਭ ਮਿਲ ਜਾਣਗੇ ਵੈਸੇ ਆਪਾਂ ਨੂੰ ਕੀ ਚੀਜ਼ ਚਾਹੀਦੀ ਮੈਮ ਕਿੱਦਾਂ ਦੀ ਚੀਜ਼ ਚਾਹੀਦੀ ਆਪਾਂ ਨੂੰ ਹਾਂਜੀ ਹਾਂਜੀ ਬਿਲਕੁਲ ਹੀ ਆਪਣੇ ਜੀ ਪ੍ਰਾਈਜ ਕੋਈ ਨਾ ਜੀ ਆਪਾਂ ਦੇਖ ਕੇ ਲਾ ਲਾਂਗੇ ਤੁਸੀਂ ਇੱਕ ਵਾਰੀ ਚੀਜ਼ ਦੇਖ ਲਿਓ ਕੋਈ ਨਹੀਂ ਤੁਸੀਂ ਦੇਖ ਲਿਓ ਕਿੱਦਾਂ ਦੀ ਚੀਜ਼ ਤੁਹਾਨੂੰ ਚਾਹੀਦੀ ਹੋਈ ਆਪਾਂ ਦੇਖ ਲਾਂਗੇ ਪੈਸਿਆਂ ਦੀ ਗੱਲ ਬਾਅਦ 'ਚ ਕਰ ਲਾਂਗੇ ਹਾਂਜੀ ਤੁਸੀਂ ਆਇਓ ਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ ਆਇਓ ਜੀ ਜ਼ਰੂਰ ਵੈਲਕਮ ਜੀ ਹਾਂਜੀ ਹਾਂਜੀ ਬਿਲਕੁਲ ਜੀ ਕੇ ਸੀ ਰੋਡ 'ਤੇ ਬਿਲਕੁਲ ਸਿੱਧੇ ਰੋਡ 'ਤੇ ਹੈ ਜੀ ਹਾਂਜੀ ਇੱਕ ਵਾਰ ਆਇਓ ਅਤੇ ਵਿਜਿਟ ਕਰਿਓ ਅਤੇ ਦੱਸਿਓ ਸਾਡੇ ਵੀ ਫਰਨੀਚਰ ਕਿੱਦਾਂ ਦਾ ਲੱਗਿਆ ਤੁਹਾਨੂੰ ਹਾਂਜੀ ਹਾਂਜੀ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਵਧੀਆ ਚੀਜ਼ ਬਣਦੀ ਆਪਣੇ ਵਧੀਆ ਕੁਆਲਟੀ ਦੀ ਹੁੰਦੀ ਆ ਗਰੰਟੀ ਦੀ ਹੁੰਦੀ ਆ ਵਧੀਆ ਚੀਜ਼ ਜੀ ਇੱਕ ਵਾਰੀ ਤੁਸੀਂ ਚੈੱਕ ਕਰਕੇ ਦੇਖ ਲਿਓ ਖੁਦ ਬਾਕੀ ਬਾਕੀ ਆਪਣੇ ਚੀਜ਼ ਵਧੀਆ ਬਣਦੀ ਆ ਹਾਂਜੀ ਬਿਲਕੁਲ ਜੀ ਵੈਲਕਮ ਜੀ ਹਾਂਜੀ ਧੰਨਵਾਦ ਜੀ ਕੌਲ ਕਰਨ ਲਈ ਹਾਂਜੀ ਥੈਂਕ ਯੂ